ਟਰੈਕਟਰਾਂ ਦੀਆਂ ਵੱਖ ਵੱਖ ਕਿਸਮਾਂ ਜਿੱਦਾਂ ਕਿ ਸਵਰਾਜ ਮਹਿੰਦਰਾ ਪ੍ਰੀਤ ਅਤੇ ਹੋਰ ਕਈ ਬਰਾਂਡਾਂ ਦੇ ਟਰੈਕਟਰ ਅੱਜ ਕੱਲ੍ਹ ਮੈਨੇ ਦੇਖੇ ਹਨ

ਜੇ ਇਹਨਾਂ ਦੇ ਉਪਯੋਗ ਦੀ ਗੱਲ ਕਰੀਏ ਤਾਂ ਇਹ ਖੇਤਾਂ ਦੇ ਵਿੱਚ ਕੱਦੂ ਕਰਨ ਟਰਾਲੀ ਦੇ ਨਾਲ ਜੋੜ ਕੇ ਸਮਾਨ ਲੈਣ ਅਤੇ ਲੈ ਕੇ ਜਾਣ ਲਈ ਵਰਤੇ ਜਾਂਦੇ ਹਨ ਪਿੰਡਾਂ ਵਿੱਚ ਕਈ ਵਾਰ ਕੋਈ ਪ੍ਰੋਗਰਾਮ ਜਾਂ ਅਸੀਂ ਮੇਲਿਆਂ ਉੱਤੇ ਜਦੋਂ ਇਕੱਠੇ ਕਿਤੇ ਜਾਣਾ ਹੋਵੇ ਤਾਂ ਅਸੀਂ ਟਰੈਕਟਰ ਨਾਲ ਟਰਾਲੀ ਨੂੰ ਜੋੜ ਕੇ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਮੇਲਿਆਂ 'ਤੇ ਤੇ ਹੋਰ ਤਿਉਹਾਰਾਂ ਉੱਤੇ ਜਾਂਦੇ ਹਾਂ ਮੈਨੂੰ ਸਭ ਤੋਂ ਪਸੰਦ ਸਵਰਾਜ ਕੰਪਨੀ ਲੱਗਦੀ ਹੈ ਪ ਪਿਛਲੇ ਟ ਸਮਿਆਂ ਦੇ ਵਿੱਚ ਹਲ ਦੇ ਨਾਲ ਹੱਥੀਂ ਕੰਮ ਕਰਨ ਨਾਲ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਸੀ ਜਦਕਿ ਟਰੈਕਟਰਾਂ ਦੇ ਨਾਲ ਅੱਜ ਕੱਲ੍ਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਕੱਦੂ ਕੀਤਾ ਜਾਂਦਾ ਹੈ ਅਤੇ ਆਉਣਾ ਜਾਣਾ ਸਮਾਨ ਜਾਂ ਕੋਈ ਸਬਜ਼ੀ ਜਾਂ ਉਹਨਾਂ ਦਾ ਕੋਈ ਹੋਰ ਸਮਾਨ ਲੈ ਕੇ ਆ ਕਿਤੋਂ ਆਉਣਾ ਜਾਂ ਜਾਣਾ ਬਹੁਤ ਹੀ ਆਸਾਨ ਹੋ ਗਿਆ ਹੈ